ਨਵਾਂ ਕਾਰੋਬਾਰ ਸ਼ੁਰੂ ਕਰਨਾ ਇੱਕ ਬਹੁਤ ਹੀ ਚੁਣੌਤੀਪੂਰਨ ਕੰਮ ਹੈ ਇਸ ਵਿੱਚ ਆਪਾਂ ਨੂੰ ਉਹ ਹੀ ਕੰਮ ਚੁਣਨਾ ਚਾਹੀਦਾ ਹੈ ਜਿਸ ਵਿੱਚ ਆਪਾਂ ਨੂੰ ਮਹਾਰਤ ਹਾਸਿਲ ਹੋਵੇ ਆਪਣੀ ਮਹਾਰਤ ਨੂੰ ਹੀ ਸਭ ਤੋਂ ਵੱਡੀ ਰਸਮ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਆਪਣੀ ਮਹਾਰਤ ਤੋਂ ਬਾਹਰ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਆਪਾਂ ਨੂੰ ਆਪਣੇ ਗੁਰੂ ਜੀ ਦਾ ਧਿਆਨ ਧਰਨਾ ਚਾਹੀਦਾ ਹੈ ਕਾਰੋਬਾਰ ਸ਼ੁਰੂ ਕਰਨ ਲਈ ਵੱਡੀ ਪੂੰਜੀ ਦੀ ਜ਼ਰੂਰਤ ਹੁੰਦੀ ਹੈ ਕਿਉਂਕੀ ਕਾਰੋਬਾਰ ਦੇ ਵੱਧਾ ਵਧਣ ਫੁੱਲਣ ਲਈ ਸਾਨੂੰ ਹਰ ਕਿਸਮ ਦੀ ਵਰਾਇਟੀ ਹਰ ਕਿਸਮ ਦੀ ਮਾਰਕੀਟਿੰਗ ਆਦੀ ਦੀ ਲੋੜ ਹੁੰਦੀ ਹੈ ਜਿਸ ਵਿੱਚ ਆਪਾਂ ਇਕੱਲੇ ਪੂਰੇ ਨਹੀਂ ਉਤਰ ਸਕਦੇ ਆਪਾਂ ਨੂੰ ਇੱਕ ਟੀਮ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਆਪਾਂ ਕਾਰੋਬਾਰ ਨੂੰ ਪੂਰਾ ਕਰ ਸਕੀਏ ਅਤੇ ਟੀਮ ਦੇ ਮੈਂਬਰਾਂ ਨੂੰ ਹਰ ਮਹੀਨੇ ਤਨਖਾਹ ਵੀ ਲੋੜੀਂਦੀ ਹੁੰਦੀ ਹੈ ਇਸ ਤੋਂ ਇਲਾਵਾ ਸਮਾਨ ਖਰੀਦਣ ਅਤੇ ਮਸ਼ੀਨਰੀ ਜਾਂ ਹੋਰ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜਿਸ ਲਈ ਇੱਕ ਵੱਡੀ ਪੂੰਜੀ ਜ਼ਰੂਰੀ ਹੋ ਜਾਂਦੀ ਹੈ